ਪੰਜਾਬ ਨੂੰ ਵਿਰਾਸਤ ਦੇ ਵਿੱਚ ਇਤਿਹਾਸ ਨੇ ਕਾਫ਼ੀ ਕੁਛ ਦਿੱਤਾ ਹੈ ਜਿਹਦੇ ਵਿੱਚ ਸਭਿਆਚਾਰ ਬਹੁਤ ਹੀ ਮਹੱਤਵਪੂਰਨ ਹੈ ਪਰ ਉਸਦੀ ਉਸੀ ਵਿਰਾ ਵਿਰਾਸਤ ਦੀ ਸੰਭਾਲ ਕਰਨਾ ਵੀ ਉੰਨਾਂ ਹੀ ਜ਼ਰੂਰੀ ਹੈ ਅਤੇ ਉਸ ਸੰਭਾਲ ਦੇ ਲਈ ਜੋ ਲੋਕ ਕਿਸ ਕੰਮ ਨੂੰ ਕਰਦੇ ਹਨ ਉਹਨਾਂ ਦੀ ਕਲਾ ਅਤੇ ਉਹਨਾਂ ਦੀ ਜੋ ਸ਼ਿਲਕ ਸ਼ਿਲਪਕਾਰੀ ਹੈ ਉਸ ਦੀ ਭੂਮਿਕਾ ਇਹਦੇ ਵਿੱਚ ਬਹੁਤ ਜ਼ਰੂਰੀ ਹੈ ਪੰਜਾਬ ਜੋ ਵੀ ਇਤਿਹਾਸ ਜੋ ਵੀ ਕਲਾਕਾਰੀ ਜੋ ਵੀ ਸੱਭਿਆਚਾਰਕ ਵਿਰਾਸਤ ਹੈ ਉਸ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਤਾਂ ਕਿ ਜੋ ਆਪਣੀਆਂ ਆਉਣ ਵਾਲੀਆਂ ਜੋ ਪੀੜ੍ਹੀਆਂ ਨੇ ਉਸਨੂੰ ਦੇਖ ਕੇ ਜਾਣ ਸਕਣ ਕੇ ਇਤਿਹਾਸ ਦੇ ਵਿੱਚ ਕੀ ਕੁਛ ਘਟਿਆ ਸੀ ਇਹਨਾਂ ਸ ਜੋ ਵੀ ਜੋ ਸੱਭਿਆਚਾਰਕ ਵਿਰਾਰ ਵਿਰਸਾਤ ਹੈ ਇਸਨੂੰ ਸੰਭਾਲਣ ਦੇ ਵਿੱਚ ਜੋ ਲੋਕ ਕੰਮ ਕਰਦੇ ਨੇ ਉਹਨਾਂ ਦੀ ਕਲਾ ਦਾ ਦੀ ਭੂਮਿਕਾ ਬਹੁਤ ਹੀ ਮਹੱਤਪੂਰਨ ਹੈ ਇੱਕ ਤਾਂ ਉਹ ਇਤਿਹਾਸ ਨੂੰ ਬਚਾ ਕੇ ਰੱਖ ਰਹੇ ਨੇ ਦੂਸਰਾ ਇਹ ਹੈ ਕਿ ਇਸਦੇ ਦੌਰਾਨ ਹੀ ਜੋ ਵੀ ਉਹ ਕੰਮ ਕਰ ਰਹੇ ਨੇ ਉਹਨਾਂ ਲਈ ਵੀ ਬਹੁਤ ਜ਼ਰੂਰੀ ਹੈ ਉਹਨਾਂ ਦੇ ਪਰਿਵਾਰਾਂ ਲਈ ਵੀ ਬਹੁਤ ਜ਼ਰੂਰੀ ਹੈ